ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਨੌਕਰੀ ਲੈਣਾ ਬਹੁਤ ਮੁਸ਼ਕਿਲ ਹੋ ਗਿਆ ਜੋ ਟੈੱਟ ਦਾ ਟੈਸਟ ਸ਼ੁਰੂ ਕਰਤਾ ਇੱਕ ਡਿਪਾਰਟਮੈਂਟਲ ਟੈਸਟ ਸ਼ੁਰੂ ਕਰਤਾ ਦਿੱਤਾ ਇਸ ਤੋਂ ਚੰਗਾ ਹੋਵੇ ਕਿ ਬੀ ਐੱਡ ਕਰਨ ਤੋਂ ਪਹਿਲਾਂ ਇਹ ਟੈਸਟ ਲੀਤੇ ਲਏ ਜਾਣ ਤਾਂ ਕਿ ਬੱਚੇ ਬੀ ਐੱਡ ਪਰ ਖਰਚਾ ਨਾਂ ਕਰਨ ਉਸ ਤੋਂ ਬਾਅਦ ਬੇਕਾਰ ਨਾਂ ਬੈਠਣ